ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਸੁਰਜੀਤ ਸਿੰਘ ਗੱਲ ਕਰ ਰਿਹਾਂ ਅਤੇ ਸਰ ਆਪਣਾ ਪੋਲ ਇੰਟਰਪ੍ਰਾਈਜ਼ ਰੂਪਨਗਰ ਤੋਂ ਗੱਲ ਕਰ ਰਹੇ ਹੋ ਜੀ ਐਕਚੁਲੀ ਸਰ ਇੱਕ ਨਾ ਫੋਨ ਔਡਰ ਕੀਤਾ ਸੀ ਮੈਂ ਤੁਹਾਡੇ ਕੋਲੋਂ ਫੋਨ ਮੈਨੂੰ ਡਿਲੀਵਰ ਹੋ ਗਿਆ ਸੀਗਾ ਜੀ ਫੋਨ ਹੈਗਾ ਜੀ ਓਪੋ ਐੱਫ ਨਾਈਨ ਪ੍ਰੋਅ ਉਹ ਸਰ ਓਪੋ ਐੱਫ ਨਾਈਨ ਪ੍ਰੋਅ ਇੰਨਾ ਵਧੀਆ ਫੋਨ ਭੇਜਿਆ ਜੀ ਤੁਸੀਂ ਪੈਕਿੰਗ ਵੀ ਇੱਕ ਨੰਬਰ ਸੀ ਉਹਦੀ ਜੀ ਪੈਕਿੰਗ ਦੇ ਵਿੱਚ ਹਰੇਕ ਚੀਜ਼ ਮੈਨੂੰ ਸੈਟਅਪ ਵਧੀਆ ਮਿਲਿਆ ਕੋਈ ਤੋੜ ਭੰਨ ਨਹੀਂ ਮਿਲੀ ਜੀ ਅਤੇ ਉਹਦੇ ਵਿੱਚ ਸਨੈਪ ਡਰੈਗਨ ਕੋਰ ਪ੍ਰੋਸੈਸਰ ਏਟ ਪੁਆਇੰਟ ਵੰਨ ਪੁਆਇੰਟ ਜ਼ੀਰੋ ਸੀ ਅਤੇ ਜਿਹਦੇ ਕਰਕੇ ਫੋਨ ਹੈਂਗ ਹੋਣ ਦੀ ਵੀ ਸਮੱਸਿਆ ਜੀਰੋ ਦੇ ਬਰਾਬਰ ਸੀ ਅਤੇ ਉਹ ਫੋਨ ਇੰਨਾ ਵਧੀਆ ਚੱਲ ਰਿਹਾ ਸੀ ਉਹਦਾ ਕੈਮਰਾ ਪੰਜਾਹ ਮੈਗਾ ਪਿਕਸਲ ਕੈਮਰਾ ਸੀ ਫਰੰਟ ਕੈਮਰਾ ਉਹਦਾ ਤੇਰ੍ਹਾਂ ਮੈਗਾ ਪਿਕਸਲ ਸੀ ਅਤੇ ਉਹਦੇ ਜਿਹੜਾ ਪ੍ਰੋਸੈਸਰ ਹੈ ਉਹਦਾ ਪ੍ਰੋਸੈਸਰ ਵੀ ਵਧੀਆ ਲੱਗਿਆ ਜੀ ਮੈਨੂੰ ਸੋਫਟਵੇਅਰ ਡਿਪਲੋਮੇਂਟ ਵੀ ਬਹੁਤ ਵਧੀਆ ਲੱਗਿਆ ਜੀ ਅਤੇ ਉਹ ਅਤੇ ਬਾਅਦ ਉਹਦਾ ਜਿਹੜਾ ਚਾਰਜਰ ਸੀ ਉਹਦਾ ਚਾਰਜਰ ਬੂਕ ਬੂਕ ਚਾਰਜਰ ਸੀ ਸਤਾਹਟ ਵਾਟ ਦਾ ਸਤਾਹਠ ਵਾਟ ਦਾ ਫਾਸਟ ਚਾਰਜਰ ਸੀ ਅਤੇ ਲਗਾ ਲਓ ਹਿਸਾਬ ਕਿ ਇੱਕ ਅ ਚਾਲ਼ੀ ਮਿੰਟ ਪੰਤਾਲੀ ਮਿੰਟ ਦੇ ਵਿੱਚ ਵਿੱਚ ਪੂਰਾ ਫੋਨ ਚਾਰਜ ਕਰ ਦਿੰਦਾ ਸੀ ਅਤੇ ਜਿਹੜਾ ਫੋਨ ਦੇ ਨਾਲ਼ ਮੈਨੂੰ ਇੱਕ ਕਵਰ ਦਿੱਤਾ ਗਿਆ ਉਹ ਕਵਰ ਲਈ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਅਤੇ ਉਹ ਕਵਰ ਸਰ ਸਿੱਲੀਕੋਨ ਕਵਰ ਸੀ ਬੈਸਟ ਕਵਰ ਸੀ ਕੈਮਰੇ ਇਹਦੇ ਵਿੱਚ ਦੋ ਦਿੱਤੇ ਗਏ ਨੇ ਫਲੈਸ਼ ਲਾਈਟ ਦਿੱਤੀ ਗਈ ਹੈ ਬੈਕ ਸਾਈਡ ਅਤੇ ਫੋਨ ਦੀ ਕੁਆਲਿਟੀ ਫੋਲ ਦੀ ਬਿਲਡ ਕੁਆਲਿਟੀ ਬਹੁਤ ਬੈਸਟ ਹੈ ਸਾਈਡ 'ਤੇ ਮਿਟਲ ਦਾ ਫਰਾਇਮ ਦਿੱਤਾ ਗਿਆ ਏ ਆ ਅਤੇ ਨਾਲ਼ ਇਹਦੇ ਇੱਕ ਮੈਨੂੰ ਗਲਾਸ ਫਰੀ 'ਚ ਤੁਸੀਂ ਧੰਨਵਾਦ ਕਰਦਾਂ ਉਸ ਚੀਜ਼ ਦਾ ਜਿਹੜਾ ਤੁਸੀਂ ਫਰੀ ਦੇ ਵਿੱਚ ਇੱਕ ਗਲਾਸ ਮੈਨੂੰ ਨਾਲ਼ ਦਿੱਤਾ ਏ ਆ ਅਤੇ ਬਾਕੀ ਸਰ ਜੇ ਇੱਕ ਹੋਰ ਬੇਨਤੀ ਕਰਾਂਗਾ ਕਿ ਜਿੰਨਾ ਹੋ ਸਕਿਆ ਅਗਰ ਮੈਨੂੰ ਇਹ ਫੋਨ ਅਗਰ ਤੁਹਾਨੂੰ ਕੋਈ ਮਿਲਦਾ ਏ ਆ ਹੋਰ ਇਹਦੇ ਨਾਲ਼ ਦਾ ਫੋਨ ਤਾਂ ਪਲੀਜ਼ ਮੈਨੂੰ ਜਿੰਨੀ ਜਲਦੀ ਤੋਂ ਜਲਦੀ ਹੋ ਸਕਿਆ ਡਿਲਵਰ ਜ਼ਰੂਰ ਕਰ ਦਿਓ ਜੀ ਅਤੇ ਬਾਕੀ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਜੀ